ਬਾਈਕ ਦੇ ਸਾਜੋ ਸਮਾਨ ਦੀ ਗੱਲ ਕੀਤੀ ਜਾਵੇ ਤਾਂ ਬਾਈਕ ਵਿੱਚ ਗੇਅਰ ਪਿਸਟਨ ਇੰਜਨ ਕਲੱਚ ਪਲੇਟ ਸੀਟ ਹੈਂਡਲ ਇਹ ਸਾਰੀਆਂ ਚੀਜ਼ਾਂ ਇੱਕ ਬਾਈਕ ਨੂੰ ਇੱਕ ਮਕੈਨੀਕਲ ਬਾਈਕ ਵਿੱਚ ਤਬਦੀਲ ਕਰਦੀਆਂ ਹਨ ਇਹ ਸਾਰੀਆਂ ਚੀਜ਼ਾਂ ਬਾਈਕ ਲਈ ਬਹੁਤ ਜ਼ਰੂਰੀ ਹਨ ਕਿਉਂਕਿ ਇਹਦੇ ਵਿੱਚੋਂ ਇੱਕ ਵੀ ਚੀਜ਼ ਤੁਹਾਡੀ ਖ਼ਰਾਬ ਹੈ ਤਾਂ ਤੁਹਾਡੀ ਬਾਈਕ ਦੀ ਅਸਫ਼ਲਤਾ ਹੋਣੀ ਜ਼ਰੂਰੀ ਹੈ ਮੇਰੇ ਨਾਲ ਬੜੀਆਂ ਅਸਫਲਤਾਵਾਂ ਇੱਦਾਂ ਹੋਈਆਂ ਹਨ ਜਦੋਂ ਮੈਂ ਲੋਂਗ ਰੂਟ ਜਾ ਰਿਹਾ ਸੀ ਜਿੱਦਾਂ ਕਿ ਜਲੰਧਰ ਤੋਂ ਲੱਦਾਖ ਮੇਰੇ ਨਾਲ ਇੱਕ ਵਾਰ ਕੀ ਹੋਇਆ ਕਿ ਬਾਈਕ ਦੀ ਕਲੱਚ ਪਲੇਟ ਖ਼ਰਾਬ ਹੋ ਗਈ ਅਤੇ ਨਾਲ ਕੋਈ ਮਕੈਨਿਕ ਵੀ ਨਹੀਂ ਸੀ ਇਸ ਕਰਕੇ ਮੈਨੂੰ ਕਾਫੀ ਟਾਈਮ ਉੱਥੇ ਰੁਕਣਾ ਪਿਆ ਅਤੇ ਮੇਰਾ ਖਰਚਾ ਹੋਰ ਵੱਧ ਗਿਆ ਜਦੋਂ ਬਾਅਦ ਵਿੱਚ ਮਕੈਨਿਕ ਆਇਆ ਤਾਂ ਉਹ ਕਹਿੰਦਾ ਤੁਹਾਡੀ ਸ ਮਕੈ ਤੁਹਾਡੀ ਕਲੱਚ ਪਲੇਟ ਅਤੇ ਨਾਲ ਨਾਲ ਤੁਹਾਡਾ ਹੈਂਡਲ ਵੀ ਟੇਡਾ ਹੈ ਜਿਸ ਕਰਕੇ ਮੇਰਾ ਖਰਚਾ ਹੋਰ ਵੱਧ ਗਿਆ